ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਹਾਂਜੀ ਸੁਖਦੀਪ ਸਿੰਘ ਜੀ ਤੁਸੀਂ ਬਿਲਕੁਲ ਸਹੀ ਜਗ੍ਹਾ 'ਤੇ ਆਏ ਹੋ ਜੀ ਤੁਹਾਨੂੰ ਮੈਂ ਦੱਸਦਾ ਜੀ ਪੰਜਾਬ ਦੇ ਵਿੱਚ ਲਗਭਗ ਬਾਰਾਂ ਹਜ਼ਾਰ ਪੰਜ ਸੌ ਪਿੰਡ ਹੈ ਜੀ ਅਤੇ ਮ ਵੈਸੇ ਤਾਂ ਸਾਰੇ ਹੀ ਪੰਜਾਬ ਵੀ ਪਿੰਡਾਂ ਦੇ ਸਮੂਹ ਤੋਂ ਮਿਲ ਕੇ ਹੀ ਪੰਜਾਬ ਬਣਿਆ ਪੰਜਾਬ ਦੇ ਵਿੱਚ ਬਹੁਤ ਹੀ ਫੇਮਸ ਸ਼ਹਿਰ ਨੇ ਅਤੇ ਪਿੰਡਾਂ ਦੀ ਵੀ ਬਥੇਰੇ ਫੇਮਸ ਨੇ ਜਿਹੜੇ ਮੰਨ ਲਓ ਵੀ ਜਿੰਨ੍ਹਾਂ ਨੂੰ ਸ਼ਹੀਦਾਂ ਦੇ ਤਾਂ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਅਜਿਹੇ ਪਿੰਡ ਵੀ ਹਨ ਜਿਵੇਂ ਹੁਣ ਜਿਵੇਂ ਕਿ ਲੈ ਲਓ ਮੇਰਾ ਪਿੰਡ ਇਤਿਹਾਸਿਕ ਪਿਛੋਕੜ ਦੇਖੀਏ ਹਾਂਜੀ ਹਾਂ ਹਾਲ ਹਾਂਜੀ ਸੁਖਦੀਪ ਸਿੰਘ ਜੀ ਤੁਹਾਨੂੰ ਮੈਂ ਦੱਸਦਾ ਵੀ ਦੇਖੋ ਸਮੇਂ ਦੇ ਨਾਲ ਨਾਲ ਤਬਦੀਲੀ ਤਾਂ ਹੁੰਦੀ ਹੈ ਹੈ ਨਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਹਾਂ ਬਾਕੀ ਪਿੰਡਾਂ ਦੇ ਵਿੱਚ ਨਾ ਜਿਹੜਾ ਭਾਈਚਾਰਾ ਅੱਜ ਵੀ ਕਾਇਮ ਹੈ ਇੱਦਾਂ ਦੀ ਕੋਈ ਗੱਲ ਨਹੀਂ ਹਰੇਕ ਵਿਅਕਤੀ ਮੰਨ ਲਓ ਹਰੇਕ ਹਰ ਇੱਕ ਦੀ ਖੁਸ਼ੀ ਦੇ ਵਿੱਚ ਗਮੀ ਦੇ ਵਿੱਚ ਸ਼ਮੂਲੀਅਤ ਕਰਦਾ ਦੁੱਖ ਸੁੱਖ ਦੇ ਵਿੱਚ ਖੜਦਾ ਆ ਹੈਂ ਕਿਸੇ ਨੂੰ ਵੀ ਕੋਈ ਕੰਮਕਾਰ ਹੁੰਦਾ ਮੰਨ ਲਓ ਵੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਲੋਕ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਸ਼ੁਰੂ ਤੋਂ ਲਾ ਲਓ ਆਪਣਾ ਪੱਛਮੀ ਸੱਭਿਆਚਾਰ ਨੂੰ ਆਪਾਂ ਜ਼ਿਆਦਾ ਮੰਨ ਲਓ ਤਰਜੀਹ ਦਿੱਤੀ ਹੈ ਸ਼ੁਰੂਆਤ ਤੋਂ ਹੀ ਫਿਰ ਵੀ ਆਪਣੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਖ਼ਾਸ ਕਰ ਆਪਣੇ ਵਿਰਸੇ ਨੂੰ ਪੂਰੀ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਜੋ ਕਿ ਅੱਜ ਵੀ ਆਪਣਾ ਇਹਨਾਂ ਦੇ ਨਾਵਾਂ ਨਾਲ ਫੇਮਸ ਨੇ ਬਹੁਤ ਜ਼ਿਆਦਾ ਬਿਲਕੁਲ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤੁਸੀਂ ਕਦੋਂ ਮਰਜ਼ੀ ਮੈਨੂੰ ਇਸ ਮੇਰਾ ਇਹ ਹੀ ਨੰਬਰ ਹੈ ਕਦੋਂ ਮਰਜੀ ਮੈਨੂੰ ਕੋਲ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਸਾਰੇ ਪਿੰਡਾਂ ਦਾ ਗਰਾਉਂਡ ਲੈਵਲ ਤੋਂ ਤੁਹਾਨੂੰ ਜਾਣਕਾਰੀ ਦੇਵਾਂਗਾ ਜੀ ਓਕੇ ਸਰ ਓਕੇ ਜੀ ਓਕੇ